ਪਹਿਲਾ ਜਿੰਨਾਂ ਡੂੰਘਾ ਖ਼ੂਹ ਖ਼ੂਹ ਖੋਦੋ ਜਿਹਨਾਂ ਖੋਦਣਾ ਪਵੇਗਾ ਜਿੱਥੇ ਪਾਣੀ ਮਿਲ ਜਾਵੇ ਜਦੋਂ ਪਾਣੀ ਮਿਲ ਜਾਵੇ ਤਾਂ ਜਿਹਨਾਂ ਡੂੰਘਾ ਖ਼ੂਹ ਖੋਦਿਆ ਉਸੇ ਹਿਸਾਬ 'ਤੇ ਬਜ਼ਾਰੋਂ ਮੋਟਰ ਲਿਆਓ ਫਿਰ ਉਸ ਮੋਟਰ ਨੂੰ ਖ਼ੂਹ ਦੇ ਐਂਡ 'ਤੇ ਜਿੱਥੇ ਖ਼ੂਹ ਖਤਮ ਹੁੰਦਾ ਉੱਥੇ ਰੱਖੋ ਅਤੇ ਤਾਰ ਪਾਓ ਬਿਜਲੀ ਦੀ ਤਾਂ ਕਿ ਮੋਟਰ ਚੱਲ ਪਏ ਅਤੇ ਨਾਲ ਉਨ੍ਹੀ ਲੰਬੀ ਪਾਈਪ ਜੋੜੋ ਅਤੇ ਬਿਜਲੀ ਦਾ ਕਨੈਕਸ਼ਨ ਮੋਟਰ ਦੀ ਜਿਹੜੀ ਪਾਵਰ ਪਾਵਰ ਪਾਵਰ ਦੇ ਅਕੋਰਡਿੰਗ ਉਹਨਾਂ ਤੁਹਾਨੂੰ ਬਿਜਲੀ ਦਾ ਕਨੈਕਸ਼ਨ ਲਗਾਉਣਾ ਪਵੇਗਾ ਅਤੇ ਬਸ ਉਸ ਤੋਂ ਬਾਅਦ ਪਾਣੀ ਦੀ ਜਿਹੜੀ ਪਾਈਪ ਪਾਈ ਹੈ ਉਹਦੇ ਨਾਲ ਤੁਹਾਨੂੰ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ